ਤਕਨੀਕੀ ਮੁਸ਼ਕਿਲ ਵਿੱਚ ਜੇਕਰ ਮੈਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਤਕਨੀਕੀ ਪ੍ਰੋਬਲਮ ਆ ਰਹੀ ਹੈ ਤਾਂ ਇਸ ਦਾ ਸਾਹਮਣਾ ਮੈਂ ਬਹੁਤ ਹੀ ਸੋਚ ਅਤੇ ਸਮਝਦਾਰੀ ਨਾਲ ਕਰਾਂਗੀ ਤਾਂ ਕਿ ਉਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਕੋਈ ਵੀ ਤਕਨੀਕੀ ਪ੍ਰੋਬਲਮ ਜਿਵੇਂ ਕਿ ਮੋਬਾਇਲ ਦੀ ਤਕਨੀਕੀ ਪ੍ਰੋਬਲਮ ਆ ਰਹੀ ਹੈ ਇਹ ਪ੍ਰੋਬਲਮ ਮੇਰੀ ਹੈ ਜਾਂ ਕਿਸੇ ਸਾਹਮਣੇ ਵਾਲੇ ਵਿਅਕਤੀ ਦੀ ਹੈ ਤਾਂ ਉਸ ਨੂੰ ਮੈਂ ਸੋਲਵ ਕਰਨ ਦੇ ਪੂਰੀ ਕੋਸ਼ਿਸ਼ ਕਰਾਂਗੀ ਜਿਵੇਂ ਕਿ ਮੋਬਾਈਲ ਵਿੱਚ ਬਾਈਫਾਈ ਕਨੈਕਟ ਨਹੀਂ ਹੋ ਰਿਹਾ ਤਾਂ ਉਸ ਨੂੰ ਆਪਣੇ ਬਾਈਫਾਈ ਕਨੈਕਟ ਕਰਨ ਲਈ ਉਸਦਾ ਸਹੀ ਪਾਸਵਰਡ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਪਾਸਵਰਡ ਸਹੀ ਨਹੀਂ ਭਰਿਆ ਹੋਇਆ ਬਾਈਫਾਈ ਹੈ ਜਾਂ ਕਿਸੇ ਮੋਬਾਇਲ ਦਾ ਹੋਟਸਪੋਟ ਆਨ ਹੈ ਤਾਂ ਉਸਨੂੰ ਉਸ ਦਾ ਪਾਸਵਰਡ ਸਹੀ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਹ ਬਾਈਫਾਈ ਜਾਂ ਹੋਟਸਪੋਰਟ ਕਨੈਕਟ ਨਹੀਂ ਹੋਵੇਗਾ ਜਿਵੇਂ ਕਿ ਕੁਛ ਐਪਸ ਦੀ ਪ੍ਰੋਬਲਮਸ ਹੁੰਦੀਆਂ ਹਨ ਕਿਸ ਕਿਸੇ ਅਣਜਾਣ ਵਿਅਕਤੀ ਨੂੰ ਜੇਕਰ ਕੋਈ ਐਪ ਨੂੰ ਵਰਤਣ ਦਾ ਨਹੀਂ ਪਤਾ ਉਸ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੇ ਇਸ ਵਿੱਚ ਕੋਈ ਛੋਟੀ ਮੋ ਛੋਟੀ ਜਾਂ ਵੱਡੀ ਕੋਈ ਤਕਨੀਕੀ ਪ੍ਰੋਬਲਮ ਆ ਰਹੀ ਹੈ ਤਾਂ ਉਸ ਨੂੰ ਇਹ ਦੱਸਣਾ ਕਿ ਇਹ ਸਟੈਪ ਬਾਏ ਸਟੈਪ ਕਿਵੇਂ ਕੰਮ ਕਰਦੀ ਹੈ ਅਤੇ ਬਹੁਤ ਹੀ ਸੂਝਵਾਨ ਢੰਗ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਸਮਝਾਉਣਾ ਜਾਂ ਖੁਦ ਪ੍ਰਿਆਸ ਕਰਕੇ ਵੇਖਣਾ ਕਿ ਇਹ ਪ੍ਰੋਬਲਮ ਕਿਉਂ ਆ ਰਹੀ ਹੈ ਕਈ ਪ੍ਰੋਬਲਮਸ ਤਕਨੀਕੀ ਪ੍ਰੋਬਲਮਸ ਕੰਪਿਊਟਰ ਰਿਲੇਟਡ ਵੀ ਆ ਜਾਂਦੀਆਂ ਹਨ ਜਿਵੇਂ ਕਿ ਅਸੀਂ ਕੰਪਿਊਟਰ ਚਲਾ ਰਹੇ ਹਾਂ ਉਸ ਵਿੱਚ ਸਾਡਾ ਨੈਟ ਨਹੀਂ ਚੱਲ ਰਿਹਾ ਜਾਂ ਸਾਡਾ ਨੈਟ ਸਹੀ ਤਰ੍ਹਾਂ ਕਨੈਕਟ ਨਹੀਂ ਹੋਇਆ ਵਾਏਫਾਏ ਜਾਂ ਫੋਨ ਨਾਲ ਅਸੀਂ ਆਪਣੇ ਨੈਟ ਨੂੰ ਕਨੈਕਟ ਕੀਤਾ ਹੋਇਆ ਹੈ ਜਾਂ ਉਸ ਸਾਡਾ ਯੂਜ ਕਰਨ ਵਾਲਾ ਲੈਪਟਾਪ ਜਾਂ ਕੰਪਿਊਟਰ ਜੋ ਅਸੀਂ ਚਲਾ ਰਹੇ ਹਾਂ ਉਸ ਦਾ ਮਾਊਸ ਨਹੀਂ ਸਹੀ ਤਰਾਂ ਕੰਨੈਕਟ ਹੋ ਰਿਹਾ ਜਾਂ ਸਾਡਾ ਕੰਪਿਊਟਰ ਦਾ ਕੋਈ ਸੋਫਟਵੇਅਰ ਨਹੀਂ ਚੱਲ ਰਿਹਾ ਤਾਂ ਉਸ ਦੀ ਸੈਟਿੰਗ ਵਿੱਚ ਜਾ ਕੇ ਅਸੀਂ ਉਸਨੂੰ ਸਹੀ ਕਰ ਸਕਦੇ ਹਾਂ ਕਈ ਵਾਰ ਸਾਡੇ ਫੋਨ ਦੀ ਸੈਟਿੰਗ ਜਿਵੇਂ ਕਿ ਕਈ ਵਾਰ ਸਾਨੂੰ ਸਾਡੇ ਫੋਨ ਦੀ ਰਿੰਗ ਨਹੀਂ ਚੱਲ ਰਹੀ ਤਾਂ ਉਸਨੂੰ ਅਸੀਂ ਚੈੱਕ ਕਰਨਾ ਕਿ ਵੀ ਇ ਇਹ ਕਿਉਂ ਔਫ ਹੈ ਤਾਂ ਉਸਨੂੰ ਆਨ ਕੀਤਾ ਜਾਵੇ ਮੋਬਾਇਲ ਦੀਆਂ ਕਈ ਸੈਟਿੰਗਸ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਕਈ ਵਾਰ ਇਸ ਪ੍ਰੋਬਲਮ ਨੂੰ ਫੇਸ ਕਰਦੇ ਹਾਂ ਉਸ ਨੂੰ ਚੈੱਕ ਕਰਕੇ ਉਸਨੂੰ ਆਨ ਕਰ ਦੇਣਾ ਹੀ ਸਾਡੀ ਪ੍ਰੋਬਲਮ ਦਾ ਸਾਲਵ ਹੈ